ਭਾਰਤ ਵਿੱਚ ਬਾਲ ਮਜ਼ਦੂਰੀ ਕਰਾਉਣੀ ਕਾਨੂੰਨ ਜੁਰਮ ਹੈ ਪਰ ਫਿਰ ਵੀ ਕੁਛ ਸ਼ੈਤਾਨ ਲੋਕ ਬੱਚਿਆਂ ਤੋਂ ਘੱਟ ਪੈਸਿਆਂ ਦੇ ਕੇ ਕੰਮ ਜ਼ਿਆਦਾ ਲੈਂਦੇ ਹਨ ਬੱਚਿਆਂ ਨੂੰ ਖਾਣ ਪੀਣ ਦਾ ਲਾਲਚ ਲਈ ਪੈਸਿਆਂ ਦੀ ਲੋੜ ਹੁੰਦੀ ਹੈ ਅਤੇ ਉਹ ਛੋਟੇ ਛੋਟੇ ਕੰਮ ਕਰਕੇ ਥੋੜ੍ਹੇ ਥੋੜ੍ਹੇ ਪੈਸੇ ਦੇ ਲਾਲਚ ਵਿੱਚ ਕੰਮ ਕਰਦੇ ਹਨ ਕੁਛ ਆਦਮੀ ਘਰ ਖਾਣਾ ਬਣਾਉਣ ਕੱਪੜੇ ਇਸ ਘਰ ਦੀ ਸਫਾਈ ਕਰਵਾਉਣ ਜੋ ਕਿ ਬਾਹਰ ਬਿਨਾਂ ਦੱਸੇ ਬੱਚਿਆਂ ਤੋਂ ਕੰਮ ਕਰਾਉਂਦੇ ਹਨ ਜੋ ਕਿ ਕਾਨੂੰਨ ਤੌਰ 'ਤੇ ਜੁਰਮ ਹੈ ਬਾਲ ਮਜਦੂਰੀ ਬਾਰੇ ਬਹੁਤ ਜ਼ਿਆਦਾ ਅਭਿਆਨ ਚਲਾਏ ਜਾਂਦੇ ਹਨ ਅਤੇ ਲੋਕਾਂ ਨੂੰ ਜਾਗਰਿਤ ਕੀਤਾ ਜਾਂਦਾ ਹੈ ਪਰ ਗਰੀਬ ਬੱਚੇ ਮਜ਼ਦੂਰੀ ਦਾ ਕੰਮ ਕਰਦੇ ਹਨ ਬਾਲ ਮਜ਼ਦੂਰੀ ਬਾਲ ਛੋਟੇ ਛੋਟੇ ਹਲਕੇ ਕੰਮਾਂ ਲਈ ਉਹਨਾਂ ਨੂੰ ਵਰਤਿਆ ਜਾਂਦਾ ਹੈ ਹੋਟਲਾਂ ਵਿੱਚ ਉਹਨਾਂ ਤੋਂ ਬਰਤਨ ਸਾਫ ਕਰਾਏ ਜਾਂਦੇ ਹਨ ਹੋਟਲਾਂ ਵਿੱਚ ਚਾਹ ਪਾਣੀ ਸਾਫ ਸਫਾਈ ਟੇਬਲ ਸਾਫ ਕਰਨ ਦਾ ਕੰਮ ਚਾਹ ਫੜਾਉਣ ਦਾ ਕੰਮ ਬੱਚਿਆਂ ਤੋਂ ਲਿਆ ਜਾਂਦਾ ਹੈ ਜੋ ਕਿ ਕਾਨੂੰਨ ਤੌਰ 'ਤੇ ਜੁਰਮ ਹੈ ਇਹ ਇਸ ਕੰਮ 'ਤੇ ਮੁਕੰਮਲ ਰੋਕ ਲੱਗਣੀ ਚਾਹੀਦੀ ਹੈ ਬੱਚਿਆਂ ਦਾ ਪੜ੍ਹਾਈ ਦਾ ਨੁਕਸਾਨ ਹੁੰਦਾ ਹੈ ਅਤੇ ਉਹ ਛੋਟੇ ਹੁੰਦੇ ਹੀ ਮਜ਼ਦੂਰੀ ਵੱਲ ਉਹਨਾਂ ਦਾ ਧਿਆਨ ਖਿੱਚਿਆ ਜਾਂਦਾ ਹੈ ਅਤੇ ਸਾਰੀ ਜ਼ਿੰਦਗੀ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ ਇਸ ਕਰਕੇ ਇਸ 'ਤੇ ਸਪੈਸ਼ਲ ਕਾਨੂੰਨ ਬਣਨਾ ਚਾਹੀਦਾ ਹੈ ਅਤੇ ਮਜ਼ਦੂਰੀ ਦਾ ਕੰਮ ਨਹੀਂ ਕਰਵਾਉਣਾ ਚਾਹੀਦਾ